ਹੈਲੋ ਆਪਣਾ ਬਰਨਾਲੇ ਤੋਂ ਬੋਲਦੇ ਸਰ ਤੁਸੀਂ ਹਾਂਜੀ ਆਪਣਾ ਬਲਜੀਤ ਫਰੂਟ ਸ਼ੋਪ ਤੋਂ ਗੱਲ ਕਰਦੇ ਹੋ ਜੀ ਹਾਂਜੀ ਸਰ ਸਾਨੂੰ ਨਾ ਥੋੜ੍ਹੇ ਜਿਹੇ ਫਰੂਟਸ ਦੀ ਜ਼ਰੂਰਤ ਸੀ ਤੁਹਾਡੇ ਕੋਲ ਕਿਹੜੀ ਤਰ੍ਹਾਂ ਦੇ ਫਰੂਟ ਮਿਲ ਜਾਣਗੇ ਸਾਨੂੰ ਅੱਛਾ ਜੀ ਹਾਂਜੀ ਐਪਲ ਕਿੰਨੀ ਕੁ ਕਿਸਮਾਂ ਦੇ ਤੁਹਾਡੇ ਕੋਲ ਅੱਛਾ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਅੱਛਾ ਜੀ ਅੱਛਾ ਅੱਛਾ ਹਾਂਜੀ ਅੱਛਾ ਜੀ ਅਤੇ ਨਹੀਂ ਫੰਕਸ਼ਨ ਹੈਗਾ ਜੀ ਮੈਰਜ ਹੈਗੀ ਬਰਦਰ ਦੀ ਉਹਦੇ ਹਾਂਜੀ ਆਪਣੇ ਹੈਗਾ ਪੰਜ ਨਵੰਬਰ ਦਸੰਬਰ ਦੀ ਆ ਮੈਰਿਜ ਹਾਂਜੀ ਉਹ ਕੁਆਂਟਿਟੀ ਸਾਨੂੰ ਇਹ ਵੀਹ ਕਿਲੋ ਕਿਹਾ ਗਿਆ ਉਹਨੇ ਆਪਣੇ ਵੀਹ ਕਿਲੋ ਤਾਂ ਐਪਲ ਕਿਹਾ ਸੀਗਾ ਹਾਂਜੀ ਬਾਕੀ ਹੋਰ ਫਰੂਟ ਵੀ ਆ ਬਨਾਨਾਜ਼ ਵੀ ਕਿਹਾ ਹੈਗਾ ਕੀਵੀ ਵਗੈਰਾ ਡਰੈਗਨ ਫਰੂਟ ਪਪੀਤਾ ਹਾਂ ਪਪੀਤਾ ਜੀ ਹਾਂਜੀ ਅਤੇ ਆਪਣਾ ਸੰਤਰਾ ਵਗੈਰਾ ਜੀ ਅੱਛਾ ਜੀ ਅੱਛਾ ਜੀ ਅੱਛਾ ਅੱਛਾ ਹਾਂ ਅੱਛਾ ਜੀ ਅੱਛਾ ਜੀ ਠੀਕ ਹੈ ਜੀ ਉਹ ਬਸ ਮੈਨੂੰ ਐਏਂ ਸੀ ਉਹ ਐਪਲ ਦੇ ਉੱਪਰ ਇੱਕ ਪਰਤ ਜਹੀ ਨੀ ਚੜ੍ਹੀ ਹੁੰਦੀ ਮੋਮ ਜਾਮ ਜਿਹੜੀ ਉਹ ਨਾ ਹੋਣ ਜੀ ਅੱਛਾ ਜੀ

ਅੱਛਾ ਜੀ ਅੱਛਾ ਜੀ ਅੱਛਾ ਜੀ ਹਾਂਜੀ ਅੱਛਾ ਜੀ ਠੀਕ ਹੈ ਜੀ ਅੱਛਾ ਅੱਛਾ ਜੀ ਹਾਂਜੀ ਹਾਂਜੀ ਮਸ਼ਹੂਰ ਕਰਕੇ ਹੀ ਅਸੀਂ ਸਾਡਾ ਤੁਹਾਡਾ ਨਾਂ ਸੁਣਿਆ ਜੀ ਉਹ ਪੈਲਸ ਵਾਲਿਆ ਨੇ ਤੁਹਾਡਾ ਕਾਰਡ ਦਿੱਤਾ ਸੀਗਾ ਹਾਂਜੀ ਅਸੀਂ ਬਰਨਾਲਾ ਰੋਡ 'ਤੇ ਪ ਆਪਣੀ ਮੈਰੀਲੈਂਡ ਆ ਜੀ ਧਨੌਲਾ ਰੋਡ 'ਤੇ ਉਹਨਾਂ ਨੇ ਤੁਹਾਡਾ ਸਾਨੂੰ ਆਹ ਕਾਰਡ ਦਿੱਤਾ ਸੀਗਾ ਅੱਛਾ ਉਹਨਾਂ ਨੇ ਤਸੱਲੀ ਲਈ ਆ ਤੁਹਾਡੀ ਅਤੇ ਬਸ ਮੈਨੂੰ ਥੋੜ੍ਹਾ ਜਿਹਾ ਮੈਂ ਕੋਈ ਕਈ ਵਾਰ ਕਮਿਸ਼ਨ ਕਮੁਸ਼ਨ ਨਾ ਨਾ ਹੋਵੇ ਅਤੇ ਹਾਂਜੀ ਹਾਂ ਹਮ ਹਮ ਹਮ ਅੱਛਾ ਹਾਂਜੀ ਹਾਂਜੀ ਹਾਂ ਜੀ ਹਾਂ ਜੀ ਚਲੋ ਸਰ ਠੀਕ ਹੈ ਜੀ ਥੈਂਕ ਯੂ ਮੈਂ ਕੱਲ੍ਹ ਨੂੰ ਆ ਕੇ ਜਾਂਦਾ ਗਾ ਜੀ ਹਾਂਜੀ ਓਕੇ ਸਰ ਥੈਂਕ ਯੂ ਜੀ